ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਕੌਣ ਹਾਂਜੀ ਹਾਂਜੀ ਕਰਵਾਈ ਦੀਆਂ ਹਾਂਜੀ ਹਾਂਜੀ ਫੋਮ ਦੀ ਹੈ ਨਾ ਕਿ ਉੱਥੇ ਸਾਡੀ ਤੁਹਾਨੂੰ ਪਹਿਲਾਂ ਸਾਡੇ ਕਲੱਬ 'ਤੇ ਵਿਜਿਟ ਕਰਨਾ ਪਵੇਗਾ ਫਿਰ ਉੱਥੇ ਤੁਹਾਡੀ ਸਭ ਤੋਂ ਪਹਿਲਾਂ ਇੱਥੇ ਰਜਿਸਟ੍ਰੇਸ਼ਨ ਫੀਸ ਜਿਹੜੀ ਆ ਉਹ ਲੱਗੇਗੀ ਜਿਸ ਤੋਂ ਬਾਅਦ ਤੁਸੀਂ ਫੋਰਮ ਫਿੱਲ ਕਰੋਗੇ ਫਿਰ ਜਿਹੜੀ ਜਿਹੜੀ ਵੀ ਐਕਟੀਵਿਟੀ ਤੁਸੀਂ ਆਪਣੇ ਬੱਚੇ ਨੂੰ ਕਰਵਾਉਣਾ ਚਾਹੁੰਦੇ ਹੋ ਉਹ ਵਾਲੀ ਫਿੱਲ ਕਰੋਗੇ ਫਿਰ ਜਿਹੜੇ ਜਿਹੜੇ ਵੀ ਚਾਰਜਿਜ ਮਤਲਬ ਕਿ ਜਿਸ ਵੀ ਐਕਟੀਵਿਟੀ ਦੇ ਪਰ ਵੀਕ ਜਾਂ ਜਿੰਨੇ ਵੀ ਚਾਰਜਿਜ ਹੋਏ ਨਾ ਉਹ ਸਾਰੇ ਤੁਹਾਨੂੰ ਫੀਲ ਉੱਥੇ ਫੋਰਮ ਦੇ ਉੱਪਰ ਹੀ ਡਿਟੇਲ ਮੈਨਸ਼ਨ ਹੋਣਗੀਆਂ ਹਾਂਜੀ ਇਨਡੋਰ ਆਊਟਡੋਰ ਦੋਨੋਂ ਐਕਟੀਵਿਟੀਜ ਪ੍ਰੈਜੈਂਟ ਹੈਗੀਆਂ ਨੇ ਮਤਲਬ ਕਹਿ ਲਓ ਕਿ ਸਵਿਮਿੰਗ ਹੈਗੀ ਹੈ ਫਿਰ ਉਹ ਹੈਗੀ ਆ ਸਕੇਟਿੰਗ ਹੈਗੀ ਹੈ ਸਵੀਮਿੰਗ ਹੋ ਗਈ ਸਕੇਟਿੰਗ ਹੋ ਗਈ ਫਿਰ ਇਨਡੋਰ ਐਕਟੀਵਿਟੀਜ਼ ਦੇ ਵਿੱਚ ਜਿਵੇਂ ਉਹਨਾਂ ਨੂੰ ਡਾਂਸਿੰਗ ਸਿੰਗਿੰਗ ਵਗੈਰਾ ਵੀ ਕਰਵਾਈ ਜਾਂਦੀ ਹੈ ਇਹ ਸਭ ਚੀਜ਼ਾਂ ਹਾਂਜੀ ਹਾਂਜੀ ਹਾਂਜੀ ਲੋਕਲ ਤਰਨਤਾਰਨ ਨੇ ਬਿਲਕੁਲ ਤੁਸੀਂ ਲੋਕਲ ਹੋ ਹਾਂਜੀ ਹਾਂਜੀ ਵੈਨ ਦੀ ਫੈਸਿਲਿਟੀ ਹੈਗੀ ਹੈ ਫੇਰ ਹਾਂਜੀ ਅਗਰ ਵੈਸੇ ਤੁਸੀਂ ਅਗਰ ਆਪ ਵੀ ਲੈ ਕੇ ਜਾਣਾ ਚਾਹੋ ਨਾ ਮਤਲਬ ਕਿਸੇ ਵੇਲੇ ਤਾਂ ਤੁਸੀਂ ਖੁਦ ਵੀ ਉਹਨਾਂ ਨੂੰ ਪਿਕਅਪ ਅਤੇ ਡਰੋਪ ਕਰ ਸਕਦੇ ਹੋ ਨਹੀਂ ਤਾਂ ਫਿਰ ਵੈਨ ਦੀਆਂ ਫਸਿਲਟੀਜ਼ ਹੈਗੀਆਂ ਹਾਂਜੀ ਹਾਂਜੀ ਠੀਕ ਹੈ ਕੋਈ ਨਹੀਂ ਰਜਿਸਟ੍ਰੇਸ਼ਨ ਵਗੈਰਾ ਜਿਹੜੀ ਹੈ ਨਾ ਬਾਰਾਂ ਵਜੇ ਤੱਕ ਹੁੰਦੀ ਹੈ ਸੋ ਤੁਸੀਂ ਬਾਰਾਂ ਵਜੇ ਤੋਂ ਕੋਸ਼ਿਸ਼ ਕਰਨਾ ਪਹਿਲਾਂ ਹੀ ਆ ਜਿਓ ਠੀਕ ਹੈ ਹਾਂਜੀ ਠੀਕ ਹੈ ਓਕੇ ਹਾਂਜੀ ਵੈਲਕਮ